ਮੇਰੀ ਮਨ ਪਸੰਦ ਪੰਜਾਬੀ ਕਵੀਆਂ ਵਿੱਚ ਇੱਕ ਅੰਮ੍ਰਿਤਾ ਪ੍ਰੀਤਮ ਹੈ ਜਿਸ ਦਾ ਕੰਮ ਇਸ ਦੀ ਭਾਵਨਾਤਮਕ ਗਹਿਰਾਈ ਅਤੇ ਗੀਤਾਕਾਰੀ ਸੁੰਦਰਤਾ ਲਈ ਵੱਖਰਾ ਹੈ ਮੈਂ ਪਿਆਰ ਨੁਕਸਾਨ ਅਤੇ ਸਮਾਜਿਕ ਨਿਆਂ ਵਰਗੇ ਵਿਸ਼ਿਆਂ ਦੀ ਉਸਦੀ ਨਿਡਰ ਖੋਜ ਲਈ ਉਸਦੀ ਪ੍ਰਸ਼ੰਸਾ ਕਰਦਾ ਹਾਂ ਜਿਸ ਨੂੰ ਉਹ ਕਮਾਲ ਦੀ ਸੰਵੇਦਨਸ਼ੀਲਤਾ ਅਤੇ ਕਿਰਪਾ ਨਾਲ ਬਿਆਨ ਕਰਦੀ ਹੈ ਉਸ ਦੀ ਕਵਿਤਾ ਅਕਸ਼ਰ ਮਨੁੱਖੀ ਸਥਿਤੀ ਅਤੇ ਔਰਤਾਂ ਦੇ ਸੰਘਰਸ਼ਾਂ ਨੂੰ ਦਰਸਾਉਂਦੀ ਹੈ ਹਾਸੀਏ 'ਤੇ ਜਾ ਆਵਾਜ਼ ਹੀ ਲੋਕਾਂ ਨੂੰ ਆਵਾਜ਼ ਪ੍ਰਦਾਨ ਕਰਦੀ ਹੈ ਉਸਦੀ ਸਭ ਤੋਂ ਮਸ਼ਹੂਰ ਰਚਨਾਵਾਂ ਵਿੱਚੋਂ ਇੱਕ ਅੱਜ ਆਖਾਂ ਵਾਰਿਸ ਸ਼ਾਹ ਨੂੰ ਭਾਰਤ ਦੀ ਵੰਡ ਦੇ ਪ੍ਰਭਾਵ ਨੂੰ ਸੰਬੋਧਿਤ ਕਰਦੀ ਹੈ ਇੱਕ ਡੂੰਘੇ ਨਿੱਜੀ ਲੈਸ ਦੁਆਰਾ ਇੱਕ ਸਮੂਹਿਕ ਦੁੱਖ ਅਤੇ ਤਾਂਘ ਨੂੰ ਪ੍ਰਗਟ ਕਰਦੀ ਹੈ ਪਰੰਪਰਾਗਤ ਪੰਜਾਬੀ ਕਵੀ ਰੂਪਾਂ ਨੂੰ ਸਮਕਾਲੀ ਵਿਸ਼ਿਆਂ ਦੇ ਨਾਲ ਮਿਲਾਉਣ ਦੀ ਪ੍ਰੀ ਪ੍ਰੀਤਮ ਦੀ ਯੋਗਤਾ ਇੱਕ ਅਮੀਰ ਟੇਸਟ ਵੀ ਬਣਾਉਂਦੀ ਹੈ ਜੋ ਪੀੜ੍ਹੀ ਦਰ ਪੀੜ੍ਹੀ ਗੂੰਜਦੀ ਹੈ ਉਸਦੇ ਕੰਮ ਵਿੱਚ ਨਿਬੰਧ ਅਤੇ ਨਾਵਲ ਵੀ ਸ਼ਾਮਿਲ ਹਨ ਜੋ ਸਮਾਜਿਕ ਮੁੱਦਿਆਂ ਅਤੇ ਨਿੱਜੀ ਪਹਿਚਾਣ ਦੀ ਪੜਚੋਲ ਕਰਦੇ ਹਨ ਅੱਗੇ ਉਸਦੀ ਬਹੁਪੱਖਤਾ ਅਤੇ ਸਮਾਜਿਕ ਟਿੱਪਣੀ ਪ੍ਰਤੀ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹਨ ਅਮ੍ਰਿੰਤਾ ਪ੍ਰੀਤਮ ਦੀ ਵਿਰਾਸਤ ਸਮਾਜਿਕ ਨਿਗਾ ਨੂੰ ਚੁਣੌਤੀ ਦਿੰਦੇ ਹੋਏ ਅਤੇ ਮਨੁੱਖੀ ਆਤਮਾ ਦੀ ਲਚਕੀਲੇਪਣ ਦਾ ਜਸ਼ਨ ਮਨਾਉਂਦੇ ਹੋਏ ਪਾਠਕਾਂ ਨਾਲ ਭਾਵਨਾਤਮਕ ਪੱਧਰ 'ਤੇ ਜੁੜਨ ਦੀ ਉਸਦੀ ਡੂੰਗੀ ਯੋਗਤਾ ਵਿੱਚ ਹੈ